ਇਕ ਬਾਈਕਰ ਜੋ ਲੰਬੇ ਸਫ਼ਰ ਲਈ ਨਿਕਲ ਰਿਹਾ ਹੈ ਇਸ ਦੌਰਾਨ ਉਸਨੂੰ ਆਪਣਾ ਸਫ਼ਰ ਅਸਾਨੀ ਨਾਲ ਪੂਰਾ ਹੋ ਸਕੇ ਇਸ ਵਾਸਤੇ ਕੁਝ ਮੈਕੈਨੀਕਲ ਗੱਲਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਹੈ ਕਿ ਉਸ ਕੋਲ ਇੱਕ ਪ੍ਰੋਪਰ ਟੂਲ ਕਿਟ ਹੋਣੀ ਚਾਹੀਦੀ ਹੈ ਤਾਂ ਕਿ ਉਸ ਵਿੱਚ ਪੇਚਕਸ ਪਲਾਸ ਚਾਬੀਆਂ ਹੋਣਗੀਆਂ ਤਾਂ ਆਰਾਮ ਨਾਲ ਕੋਈ ਵੀ ਮਕੈਨੀਕਲ ਪ੍ਰੋਬਲਮ ਆਉਂਦੀ ਹੈ ਤਾਂ ਉਸਨੂੰ ਉਹ ਸੋਲਵ ਕਰ ਸਕੇ ਸੁਲਝਾ ਸਕੇ ਦੂਸਰੀ ਗੱਲ ਜੋ ਮੈਂ ਕਹਿਣਾ ਚਾਅ ਰਿਹਾ ਉਹਦੇ ਕੋਲ ਇੱਕ ਪੰਪ ਦੀ ਵਿਵਸਥਾ ਹੋਣੀ ਚਾਹੀਦੀ ਆ ਤਾਂ ਜੋ ਅਗਰ ਬਾਈਕ ਦੇ ਟੈਰ ਦੀ ਹਵਾ ਕੁਝ ਘੱਟ ਹੋ ਜਾਵੇ ਤਾਂ ਉਹ ਪੰਪ ਦੀ ਮਦਦ ਨਾਲ ਉਸ ਵਿੱਚ ਏ ਹਵਾ ਦੀ ਪੂਰਤੀ ਕਰ ਸਕੇ ਅਗਲੀ ਗੱਲ ਜੋ ਹੈ ਉਸ ਬਾਈਕਰ ਨੂੰ ਬਾਈਕ ਦੇ ਸਪਾਰਕ ਪਲੱਗ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਅਗਰ ਕਦੀ ਸਪਾਰਕ ਪਲੱਗ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸਨੂੰ ਖੋਲ੍ਹ ਕੇ ਉਹ ਸਾਫ਼ ਕਰ ਸਕੇ ਉਸ ਬਾਈਕਰ ਨੂੰ ਕਲੱਚ ਅਤੇ ਬ੍ਰੇਕ ਦੀਆਂ ਤਾਰਾਂ ਬਾਰੇ ਕੁਝ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਢਿੱਲੇ ਜਾਂ ਫਿਰ ਜੇ ਕੋਈ ਏ ਲੂਜ ਹੋਏ ਸਕਰੀਊਸ ਉਸਨੂੰ ਕੱਸ ਸਕੇ ਸਭ ਤੋਂ ਬਹੁਤ ਮਹੱਤਵਪੂਰਨ ਚੀਜ਼ ਹੈ ਬਾਈਕਰ ਨੂੰ ਜਾਣ ਤੋਂ ਪਹਿਲਾਂ ਉਸ ਦੀ ਬਾਈਕ ਦੀ ਸ ਪ੍ਰੋਪਰ ਸਰਵਿਸ ਕਰਵਾ ਲੈਣੀ ਚਾਹੀਦੀ ਹੈ ਟਾਈਰ ਟਿਊਬ ਚੈੱਕ ਕਰਵਾ ਲੈਣੇ ਚਾਹੀਦੇ ਹਨ ਤਾਂ ਜੋ ਉਹਦੀ ਕੋਈ ਸਮੱਸਿਆ ਨਾ ਰਹੇ ਮੈਂ ਕੇ ਇੱਕ ਵਾਰ ਲੰਬੇ ਸਫ਼ਰ 'ਤੇ ਗਿਆ ਅਤੇ ਮੇਰੇ ਬਾਈਕ ਦੀ ਲਾਈਟ ਖ਼ਰਾਬ ਹੋ ਗਈ ਸੀ ਮੇਰੇ ਕੋਲ ਟੂਲ ਕਿੱਟ ਸੀ ਸੋ ਮੈਂ ਉਸਦਾ ਬਲਬ ਇਕ ਬਦਲ ਕੇ ਉਸ ਨੂੰ ਦਰੁਸਤ ਕੀਤਾ ਸੀ